ਜਿਵੇਂ ਮੈਂ ਰੋਜ਼ ਯੋਗਾ ਕਰਦੀ ਹਾਂ ਅਤੇ ਮੈਨੂੰ ਉਹਦੇ ਲਾਭ ਪਤਾ ਨੇ ਅਤੇ ਜੇ ਕੋਈ ਨਵਾਂ ਵਿਅਕਤੀ ਯੋਗਾ ਦੇ ਵਿੱਚ ਆਉਣਾ ਪਸੰਦ ਕਰੇਗਾ ਅਤੇ ਮੈਂ ਉਹਨੂੰ ਇਹ ਹੀ ਅਭਿਆਸ ਵਿੱਚ ਉਹਨੂੰ ਇਹ ਹੀ ਸਲਾਹ ਦੇਵਾਂਗੀ ਕਿ ਉਹ ਉਹਨੂੰ ਚੀਜ਼ਾਂ ਨੂੰ ਸਾਵਧਾਨੀ ਨਾਲ ਕਰੇ ਤਾਂ ਕਿ ਜੇ ਉਹ ਜਲਦਬਾਜ਼ੀ ਕਰੇਗਾ ਅਤੇ ਉਹਦੇ ਵਿੱਚ ਕੋਈ ਨਾ ਕੋਈ ਉਹਦੇ ਮਸਲਜ਼ ਨੂੰ ਜਾਂ ਉਹਦੇ ਬੋਨਸ ਨੂੰ ਦਿੱਕਤ ਆ ਸਕਦੀ ਹੈ ਜੋ ਦਿੱਕਤਾਂ ਕਈ ਵਾਰ ਕਾਫ਼ੀ ਲੰਬੇ ਸਮੇਂ ਤੱਕ ਚੱਲਦੀਆਂ ਨੇ ਅਤੇ ਉਸ ਤੋਂ ਬਾਅਦ ਇਹ ਵੀ ਹੋ ਸਕਦਾ ਹੈ ਕਿ ਉਹਨੂੰ ਆਪਣੀ ਆਉਣ ਵਾਲੀ ਜ਼ਿੰਦਗੀ 'ਚ ਕਾਫ਼ੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਵੇ ਅਤੇ ਮੈਂ ਉਹਨੂੰ ਇਹ ਹੀ ਸਲਾਹ ਦਵਾਂਗੀ ਕਿ ਉਹ ਸਾਰੇ ਆਸਣਾਂ ਨੂੰ ਚੰਗੀ ਤਰ੍ਹਾਂ ਸਮਝੇ ਅਤੇ ਉਸ ਤੋਂ ਬਾਅਦ ਸਾਵਧਾਨੀ ਨਾਲ ਕਰੇ ਤਾਂ ਕਿ ਉਸਨੂੰ ਅੱਗੇ ਜਾ ਕੇ ਕੋਈ ਵੀ ਬੌਡੀ 'ਚ ਕੋਈ ਵੀ ਪ੍ਰੋਬਲਮ ਜਾਂ ਕੋਈ ਵੀ ਦਿੱਕਤ ਨਾ ਆ ਸਾ ਆ ਪਾਵੇ ਅਤੇ ਦੂਜਾ ਮੈਂ ਉਹਨੂੰ ਇਹ ਸਲਾਹ ਦੇਣਾ ਚਾਹਵਾਂਗੀ ਕਿ ਜੇ ਉਹ ਆਪ ਚੰਗੀ ਤਰ੍ਹਾਂ ਕਰੇਗਾ ਸਾਵਧਾਨੀ ਨਾਲ ਕਰੇਗਾ ਅਤੇ ਉਸ ਤੋਂ ਜੋ ਲਾਭ ਉਹਨੂੰ ਮਿਲਣਗੇ ਉਹ ਅੱਗੇ ਜਾ ਕੇ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕਰ ਸਕਦਾ ਹੈ ਅਤੇ ਉਸ ਤੋਂ ਇਲਾਵਾ ਇਹਦੇ ਨਾਲ ਹੋਰ ਲੋਕ ਵੀ ਯੋਗਾ ਕਰਨ ਦੇ ਅਭਿਆਸ ਵਿੱਚ ਆਉਣਗੇ ਅਤੇ ਯੋਗਾ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਗੇ ਜਿਸ ਨਾਲ ਹਰ ਇੱਕ ਨੂੰ ਇੱਕ ਨਵਾਂ ਲਾਭ ਅਤੇ ਇੱਕ ਨਵੀਂ ਜਾਣਕਾਰੀ ਯੋਗਾ ਬਾਰੇ ਮਿਲੇਗੀ ਜਿਸ ਨਾਲ ਉਹ ਆਪਣੀ ਜ਼ਿੰਦਗੀ ਨੂੰ ਹੋਰ ਪੀਸ ਨਾਲ ਅੱਗੇ ਵਧਾ ਸਕਦੇ ਨੇ ਅਤੇ ਆਪਣੀ ਜ਼ਿੰਦਗੀ ਨੂੰ ਅੱਗੇ ਚੰਗੇ ਤਰੀਕੇ ਨਾਲ ਜੀ ਸਕਦੇ ਨੇ ਜਿਸ ਨਾਲ ਉਹਨਾਂ ਦੇ ਸਰੀਰ ਵਿੱਚ ਵੀ ਜ਼ਿਆਦਾ ਫੁਰਤੀ ਆਏਗੀ ਅਤੇ ਉਹਨਾਂ ਨੂੰ ਸਵੇਰੇ ਸਵੇਰੇ ਜਿਵੇਂ ਰੋਜ਼ ਯੋਗਾ ਕਰਕੇ ਉਹਨਾਂ ਨੂੰ ਚੰਗਾ ਲੱਗੇਗਾ ਅਤੇ ਉਹਨਾਂ ਦੇ ਅੰਦਰ ਇੱਕ ਪੋਜ਼ੀਟਿਵ ਐਨਰਜ਼ੀ ਆਵੇਗੀ ਜਿਹਦੇ ਨਾਲ ਉਹਨਾਂ ਦਾ ਪੂਰਾ ਦਿਨ ਚੰਗਾ ਨਿਕਲੇਗਾ